ਪਸ਼ੂਆਂ ਦੇ ਗੋਬਰ ਦੀ ਵਰਤੋਂ ਖਾਦ ਦੇ ਤੌਰ ਦੇ ਵਿੱਚ ਖੇਤਾਂ ਦੇ ਵਿੱਚ ਕੀਤੀ ਜਾਂਦੀ ਹੈ ਜੋ ਕਿ ਖੇਤੀ ਫਸਲਾਂ ਨੂੰ ਬਹੁਤ ਲਾਭਦਾਇਕ ਹੁੰਦੀ ਹੈ ਗੋਬਰ ਦੀਆਂ ਪਾਥੀਆਂ ਬਣਾ ਕੇ ਵੇਚੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਸਾਡੇ ਘਰ ਵਿੱਚ ਮੱਝਾਂ ਰੱਖੀਆਂ ਹੁੰਦੀਆਂ ਅਸੀਂ ਉਸ ਦਾ ਗੋਬਰ ਚੱਕਣਾ ਚੱਕ ਕੇ ਉਹਦੇ ਨਾਲ ਅੱਗੇ ਘਰ ਕੱਚੇ ਹੁੰਦੇ ਸੀ ਵਿਹੜੇ ਲਿੱਪਣੇ ਹੁੰਦੇ ਸੀ ਜਾਂ ਗੋਬਰ ਦੇ ਵਿੱਚ ਮਿੱਟੀ ਮਿਲਾ ਕੇ ਉਸ ਨੂੰ ਲਿਪਿਆ ਜਾਂਦਾ ਸੀਗਾ ਜੋ ਘਰ ਬਹੁਤ ਸੋਹਣੇ ਬਣ ਜਾਂਦੇ ਸੀਗੇ ਗੋਬਰ ਨੂੰ ਆਪਣੀਆਂ ਤਿਆਰੀਆਂ ਦੇ ਵਿੱਚ ਪਾ ਦੇਣਾ ਕਿਆਰੀਆਂ 'ਚ ਪਾ ਕੇ ਉਸਦੇ ਖਾਦ ਦੇ ਤੌਰ 'ਤੇ ਮ ਉਹ ਕਰਨਾ ਸ਼ਾਮ ਨੂੰ ਪਾਥੀ ਬਾਲ ਕੇ ਉਹਦਾ ਧੁੰਆਂ ਕਰਕੇ ਜੋ ਕਿ ਮੱਛਰਾਂ ਤੋਂ ਮੱਛਰਾਂ ਨੂੰ ਦੂਰ ਦਿੱਤਾ ਜਾਂਦਾ ਸੀ ਗੋਬਰ ਨੂੰ ਗੋਬਰ ਗੋਬਰ ਦੀਆਂ ਪਾਥੀਆਂ ਬਣਾ ਕੇ ਅਸੀਂ ਵੇਚਦੇ ਹਾਂ ਪਾਥੀਆਂ ਜੋ ਕਿ ਸ਼ਹਿਰਾਂ ਦੇ ਵਿੱਚ ਨਹੀਂ ਮਿਲਦੀਆਂ ਅੱਜ ਕੱਲ੍ਹ ਦੇ ਜੀਵਨ 'ਚ ਬੱਚਿਆਂ ਨੂੰ ਤਾਂ ਇਸ ਬਾਰੇ ਗੋਬਰ ਦੀ ਵਰਤੋਂ ਬਾਰੇ ਪਤਾ ਨਹੀਂ ਹੁੰਦਾ ਪਰ ਇਸ ਨੂੰ ਪਿੰਡਾਂ ਦੇ ਵਿੱਚ ਇਸ ਬਾਰੇ ਬਹੁਤ ਜਾਣਕਾਰੀ ਹੁੰਦੀ ਹੈ ਗੋਬਰ ਨੂੰ ਅਗਰ ਖੇਤਾਂ ਦੇ ਵਿੱਚ ਲਿਜਾ ਕੇ ਵਰਤਿਆ ਜਾਵੇ ਖੇਤਾਂ 'ਚ ਪਾਇਆ ਜਾਵੇ ਤਾਂ ਫਸਲ ਬਹੁਤ ਵਧੀਆ ਹੁੰਦੀ ਹੈ ਮੁਰਗੀ ਪਾਲਣ ਵਿੱਚ ਬਿੱਠਾਂ ਮੁਰਗੀ ਦੀਆਂ ਬਿੱਠਾਂ ਦੀ ਖੇਤਾਂ 'ਚ ਕੀਤੀ ਜਾਂਦੀ ਹੈ ਜਿਸ ਜਗ੍ਹਾ 'ਤੇ ਨਾਈਟਰੋਜਨ ਦੀ ਕਮੀ ਹੋਵੇ ਉੱਥੇ ਬਿੱਠਾ ਵਰਤੀਆਂ ਸੁੱਟੀਆਂ ਜਾਂਦੀਆਂ ਹਨ ਕਿਉਂਕਿ ਮਿੱਟੀ ਦੇ ਵਿੱਚ ਮਿਲਾ ਕੇ ਉਸ ਦੀ ਵਰਤੋਂ ਕੀਤੀ ਜਾਂਦੀ ਹੈ